ਬਹੁਤ ਸਾਰੇ ਲੋਕ ਨੇ ਜਿਹੜੇ ਪੌਦਿਆਂ ਨੂੰ ਬੂਟਿਆਂ ਨੂੰ ਪਿਆਰ ਕਰਦੇ ਨੇ ਔਰ ਵੰਨ ਸੁਵੰਨੇ ਜਿਹੜੇ ਬੂਟੇ ਨੇ ਉਹ ਘਰਾਂ ਦੇ ਵਿੱਚ ਲਾਉਣੇ ਉਹਨਾਂ ਦਾ ਸ਼ੌਕ ਹੁੰਦਾ ਹੈ ਉਹਨਾਂ ਦੀ ਪਾਲਣਾ ਕਰਨਾ ਉਹਨਾਂ ਨੂੰ ਗੋਡੀ ਕਰਨਾ ਪਾਣੀ ਦੇਣਾ ਸੜ ਚੁੱਕੇ ਪੌਦੇ ਜਿਹੜੇ ਹਟਾ ਕੇ ਉਹਨਾਂ ਦੀ ਥਾਂ 'ਤੇ ਨਵੇਂ ਪੌਦੇ ਜਿਹੜੇ ਉਹ ਲਾਉਣਾ ਅਤੇ ਮੈਂ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹਾਂ ਮੇਰਾ ਜਿਹੜਾ ਘਰ ਹੈ ਉਹਦਾ ਸਾਰਾ ਵਿਹੜਾ ਹੀ ਫੁੱਲਾਂ ਦੇ ਸਦਾ ਬਹਾਰੀ ਜਿਹੜੇ ਬੂਟੇ ਨੇ ਉਹਨਾਂ ਨਾਲ ਸੋਹਣੀਆ ਸੋਹਣੀਆਂ ਵੇਲਾਂ ਦੇ ਨਾਲ ਭਰਿਆ ਪਿਆ ਹੈ ਔਰ ਇਹਨਾਂ ਬੂਟਿਆਂ ਦੀ ਜਿਹੜੀ ਦੇਖਭਾਲ ਕਰਨੀ ਉਹ ਉਹਦਾ ਮੈਨੂੰ ਬਹੁਤ ਸ਼ੌਕ ਹੈ ਪਰ ਦੋ ਮੌਸਮ ਨੇ ਜਿਹੜੇ ਇਹਨਾਂ ਨੂੰ ਜਾਂ ਤਾਂ ਪੂਰੀ ਤਰ੍ਹਾਂ ਖਰਾਬ ਕਰ ਦਿੰਦੇ ਨੇ ਜਾਂ ਬਰਬਾਦ ਕਰ ਦਿੰਦੇ ਨੇ ਉਹ ਹੈ ਇੱਕ ਜਦੋਂ ਸੋਕਾ ਪੈਂਦਾ ਹੈ ਉਸ ਸਮੇਂ ਦੇ ਉੱਪਰ ਇਹਨਾਂ ਬੂਟਿਆਂ ਦੀ ਜਿਹੜੀ ਦੇਖਭਾਲ ਉਹ ਕਰਨੀ ਜਿਹੜੀ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਜਾਂ ਫੇਰ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਹੈ ਤਾਂ ਅਸੀਂ ਨਾ ਤਾਂ ਉਹਨਾਂ ਬੂਟਿਆਂ ਨੂੰ ਕਿਤੇ ਹੋਰ ਰੱਖ ਸਕਦੇ ਹਾਂ ਅਤੇ ਨਾ ਹੀ ਅਸੀਂ ਜਿਹੜੀ ਬਾਰਿਸ਼ ਹੈ ਉਹਦੇ ਤੋਂ ਉਹਨਾਂ ਨੂੰ ਬਚਾ ਸਕਦੇ ਹਾਂ ਪਰ ਫਿਰ ਵੀ ਮੈਂ ਕੋਈ ਨਾ ਕੋਈ ਜੁਗਾੜ ਜਿਹੜਾ ਹੈ ਉਹਨਾਂ ਬੂਟਿਆਂ ਦਾ ਨੂੰ ਬਚਾਉਣ ਲਈ ਜਿਹੜਾ ਹੈ ਉਹ ਕਰ ਹੀ ਲੈਂਦੀ ਹਾਂ ਜਿਵੇਂ ਹੁਣ ਮੇਰੇ ਵਿਹੜੇ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪੌਦੇ ਨੇ ਕਿਸੇ ਨੂੰ ਪਾਣੀ ਥੋੜ੍ਹਾ ਘੱਟ ਦੇਣਾ ਹੈ ਜੀ ਕਿਸੇ ਨੂੰ ਦੋ ਤਿੰਨ ਦਿਨ ਬਾਅਦ ਦੇਣਾ ਹੈ ਕਿਸੇ ਨੂੰ ਰੋਜ਼ ਉਹਦੀ ਜ਼ਰੂਰਤ ਹੈ ਕਿ ਅਗਰ ਉਸਨੂੰ ਰੋਜ਼ ਜਿਹੜਾ ਪਾਣੀ ਹੈ ਉਹ ਨਾ ਪਾਇਆ ਜਾਵੇ ਤਾਂ ਉਹ ਸੁੱਕ ਸੜ ਜਾਂਦੇ ਨੇ ਜੇ ਮੈਨੂੰ ਕਦੇ ਲੱਗੇ ਕਿ ਹੁਣ ਬਾਰਿਸ਼ ਦਾ ਜਿਹੜਾ ਮੌਸਮ ਹੈ ਮੀਂਹ ਪੈਣ ਦਾ ਮੌਸਮ ਜਿਹੜਾ ਹੈ ਉਹ ਆ ਗਿਆ ਹੈ ਤਾਂ ਮੈਂ ਇੱਕ ਇੱਕ ਦੋ ਦਿਨ ਪਹਿਲਾਂ ਹੀ ਜਿਹੜਾ ਪੌਦੇ ਹੈ ਉਹਨਾਂ ਨੂੰ ਪਾਣੀ ਦੇਣਾ ਥੋੜ੍ਹਾ ਘੱਟ ਕਰ ਦਿੰਦੀ ਹਾਂ ਪਰ ਫੇਰ ਵੀ ਜੇ ਮੌਸਮ ਜ਼ਿਆਦਾ ਖਰਾਬ ਹੋ ਜਾਵੇ ਜਾਂ ਮੀਂਹ ਜ਼ਿਆਦਾ ਪੈ ਪੈ ਜਾਵੇ ਪੈਣ ਦੀ ਸੰਭਾਵਨਾ ਹੋਵੇ ਜਾਂ ਪੈ ਰਿਹਾ ਹੋਵੇ ਤਾਂ ਮੈਂ ਆਪਣੇ ਕੋਲ ਉਸ ਤੋਂ ਪੌਦਿਆਂ ਦੇ ਬਚਾਅ ਦੇ ਲਈ ਜਿਹੜੇ ਲਿਫਾਫੇ ਨੇ ਉਹਨਾਂ ਨੂੰ ਜੋੜ ਜੋੜ ਕੇ ਇੱਕ ਚਾਦਰ ਜਿਹੀ ਬਣਾਈ ਹੋਈ ਹੈ ਅਤੇ ਮੈਂ ਇਹਨਾਂ ਫੁੱਲਾਂ ਨੂੰ ਉਹਦੇ ਨਾਲ ਚੰਗੀ ਤਰ੍ਹਾਂ ਢਕ ਦਿੰਦੀ ਹਾਂ ਉਹਦਾ ਫਾਇਦਾ ਮੈਨੂੰ ਇਹ ਹੁੰਦਾ ਹੈ ਕਿ ਜੇ ਤੇਜ਼ ਹਨੇਰੀ ਵੀ ਆ ਜਾਵੇ ਜਾਂ ਲੋੜ ਤੋਂ ਜ਼ਿਆਦਾ ਵੀ ਜੇ ਅਗਰ ਮੀਂਹ ਜਿਹੜਾ ਹੈ ਉਹ ਪੈ ਜਾਵੇ ਤਾਂ ਇਹ ਜਿਹੜੇ ਪੌਦੇ ਨੇ ਉਹ ਉਹਨਾਂ ਲਿਫਾਫਿਆਂ ਦੇ ਜ਼ਰੀਏ ਇਹਨਾਂ 'ਤੇ ਜਿਹੜਾ ਪਾਣੀ ਹੈ ਉਹਦਾ ਕੋਈ ਵੀ ਅਸਰ ਨਹੀਂ ਹੁੰਦਾ ਅਤੇ ਇਹ ਬਚ ਜਾਂਦੇ ਨੇ ਮੈਂ ਜਦ ਫਿਰ ਬਾਰਿਸ਼ ਹਟਦੀ ਹੈ ਫਿਰ ਮੈਂ ਇਹ ਜਿਹੜੇ ਇਹਦੇ 'ਤੇ ਪਾਏ ਹੋਏ ਲਿਫਾਫੇ ਵਗੈਰਾ ਨੇ ਉਹਨਾਂ ਸਾਰਿਆਂ ਨੂੰ ਹਟਾ ਦਿੰਦੀ ਹਾਂ ਫਿਰ ਇਹਨਾਂ ਨੂੰ ਧੁੱਪ ਲੱਗਦੀ ਹੈ ਧੁੱਪ ਲੱਗ ਕੇ ਇਹ ਪੌਦੇ ਫੇਰ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਜਿਹੜੇ ਨੇ ਹੋ ਜਾਂਦੇ ਨੇ ਜ਼ਿਆਦਾ ਗਰਮੀ ਦਾ ਮੌਸਮ ਹੋਵੇ ਤਾਂ ਮੇਰੇ ਘਰ ਦੇ ਵਿੱਚ ਇੱਕ ਪੋਰਚ ਬਣੀ ਹੋਈ ਹੈ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉੱਥੇ ਇਹ ਸਾਰੇ ਪੌਦੇ ਇੱਕੋ ਜਗ੍ਹਾ ਦੇ ਉੱਪਰ ਰੱਖ ਦਿੰਦੀ ਹਾਂ ਕਈ ਵਾਰੀ ਸ਼ਾਮਾਂ ਨੂੰ ਇਹਨਾਂ ਨੂੰ ਪਾਣੀ ਦੇ ਕੇ ਸ਼ਾਮ ਦੇ ਵੇਲੇ ਕਿਉਂਕਿ ਸਵੇਰ ਵੇਲੇ ਜਿਹੜਾ ਦਿੱਤਾ ਹੋਇਆ ਪਾਣੀ ਬੂਟਿਆਂ ਨੂੰ ਹੈ ਜਦੋਂ ਗਰਮੀ ਪੈਂਦੀ ਹੈ ਤਾਂ ਇਹ ਉਹਨਾਂ ਨੂੰ ਜਿਹੜਾ ਹੈ ਸਾੜ ਦਿੰਦਾ ਹੈ ਸਾੜ ਪਾਉਂਦਾ ਹੈ ਅਤੇ ਕੋਸ਼ਿਸ਼ ਕਰਦੀ ਹਾਂ ਕਿ ਇਹਨਾਂ ਨੂੰ ਸ਼ਾਮ ਦੇ ਵੇਲੇ ਜਿਹੜਾ ਹੈ ਉਹ ਪਾਣੀ ਪਾਇਆ ਜਾਵੇ ਅਤੇ ਸ਼ਾਮੀ ਮੈਂ ਇਹਨਾਂ ਨੂੰ ਪਾਣੀ ਪਾ ਕੇ ਛਾਂਵੇ ਰੱਖ ਕੇ ਕੋਸ਼ਿਸ਼ ਕਰਦੀ ਹਾਂ ਇਹ ਗਰਮੀ ਦੇ ਮੌਸਮ ਵਿੱਚ ਦੋ ਮਹੀਨੇ ਮੈਂ ਇਹਨਾਂ ਨੂੰ ਉਸ ਛਾਂ ਦੇ ਵਿੱਚ ਹੀ ਰਹਿਣ ਦੇਵਾਂ ਤਾਂ ਕਿ ਇਹ ਚੰਗੀ ਤਰ੍ਹਾਂ ਜਿਹੜੇ ਨੇ ਵੱਧ ਫੁੱਲ ਸਕਣ ਅਤੇ ਹਰਿਆਲੀ ਜਿਹੜੀ ਹੈ ਉਹ ਦੇ ਸਕਣ ਜਿਵੇਂ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਅਗਰ ਅਸੀਂ ਉਹਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਅਸੀਂ ਚੰਗੀ ਖੁਰਾਕ ਲੈਂਦੇ ਹਾਂ ਐਕਸਰਸਾਈਜ਼ ਕਰਦੇ ਹਾਂ ਆਪਣੇ ਆਪ ਨੂੰ ਸਿਹਤਮੰਦ ਬਣਾਉਣ ਲਈ ਜਿਹੜਾ ਕੋਈ ਫਰੂਟ ਵਗੈਰਾ ਉਹ ਖਾਂਦੇ ਹਾਂ ਠੀਕ ਇਸ ਤਰ੍ਹਾਂ ਅਗਰ ਅਸੀਂ ਬੂਟਿਆਂ ਨੂੰ ਵਧੀਆ ਹੈਲਦੀ ਸਿਹਤਮੰਦ ਬਣਾਉਣਾ ਹੈ ਤਾਂ ਸਾਨੂੰ ਇਹਦੀ ਵੀ ਉਸ ਤਰ੍ਹਾਂ ਹੀ ਜਿਹੜੀ ਹੈ ਦੇਖਭਾਲ ਜਿਹੜੀ ਉਹ ਕਰਨੀ ਪੈਂਦੀ ਹੈ ਅਤੇ ਕਰਨੀ ਵੀ ਚਾਹੀਦੀ ਹੈ ਅਤੇ ਮੈਂ ਪੂਰੀ ਤਰ੍ਹਾਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹਾਂ ਉਸ ਤਰ੍ਹਾਂ ਹੀ ਮੈਂ ਇਹਨਾਂ ਬੂਟਿਆਂ ਦਾ ਜਿਹੜਾ ਉਹ ਖਿਆਲ ਰੱਖਣ ਦੀ ਪੂਰੀ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਅਤੇ ਕਈ ਵਾਰੀ ਸਮੇਂ ਸਮੇਂ ਇਹਨਾਂ ਨੂੰ ਦੇ ਵਿੱਚ ਜਿਹੜੀਆਂ ਸੁੱਕੀਆਂ ਟਾਹਣੀਆਂ ਨੇ ਕੈਂਚੀ ਦੇ ਨਾਲ ਮੈਂ ਉਹਨਾਂ ਨੂੰ ਕੱਟ ਦਿੰਦੀ ਹਾਂ ਉਹਦੀ ਥਾਂ 'ਤੇ ਫਿਰ ਜਿਹੜੀਆਂ ਨਵੀਆਂ ਟਾਹਣੀਆਂ ਉਹ ਪੁੰਗਰ ਆਉਂਦੀਆਂ ਨੇ ਜਿਸ ਜਿਸ ਡੋਡੀ ਦੇ ਉੱਪਰ ਜਿਹੜੇ ਫੁੱਲ ਉਹ ਖਿੜਦੇ ਨੇ ਜਦੋਂ ਉਹ ਫੁੱਲ ਖਿੜ ਕੇ ਸੁੱਕ ਜਾਂਦੇ ਨੇ ਅਤੇ ਮੈਂ ਕੈਂਚੀ ਦੇ ਨਾਲ ਉਹ ਉਸ ਜਿਹੜੀ ਸੁੱਕੀ ਹੋਈ ਡਾਲੀਆਂ ਨੂੰ ਕੱਟ ਦਿੰਦੀ ਹਾਂ ਇਹਦੇ ਨਾਲ ਜਿਹੜਾ ਪੌਦਾ ਹੈ ਉਹ ਪਹਿਲਾਂ ਵਾਂਗੂ ਫਿਰ ਨਵਾਂ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਵਾਧਾ ਵੀ ਉਹਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ